ਮੈਂ ਜੀ ਜੀਵਣ ਲਈ ਖੇਤੀਬਾੜੀ ਨੂੰ ਆਪਣਾ ਸਾਧਨ ਬਣਾਇਆ ਹੋਇਆ ਅਤੇ ਮੇਰੇ ਕੋਲ ਜਿਵੇਂ ਕਿ ਹੈ ਇੱਕ ਚੰਗੀ ਜ਼ਮੀਨ ਹੈ ਅਤੇ ਮੈਂ ਉਸ 'ਚ ਅਲੱਗ ਅਲੱਗ ਮੌਸਮ ਦੇ ਹਿਸਾਬ ਨਾਲ ਅਲੱਗ ਅਲੱਗ ਫਸਲਾਂ ਬੀਜਦਾ ਰਹਿੰਦਾ ਅਤੇ ਇਹਦੇ ਨਾਲ਼ ਨਾਲ਼ ਮੈਂ ਕੁਛ ਕੁ ਜਮੀਨ 'ਚ ਆਪਣੇ ਖਾਣ ਲਈ ਅਤੇ ਕੁਝ ਕੁਝ ਕੁ ਮੰਡੀ ਲਈ ਸਬਜੀਆਂ ਵਗੈਰਾ ਵੀ ਉਗਾਉਂਦਾ ਰਹਿਨਾ ਜਿਹਦੇ ਨਾਲ ਮੈਨੂੰ ਮੇਰੀ ਔਰਗੈਨਿਕ ਸਬਜੀ ਮਿਲਦੀ ਹੈ ਅਤੇ ਜਿਹੜੀ ਕਿ ਸਪਰੇਅ ਵਗੈਰਾ ਅਤੇ ਬਿਮਾਰੀਆਂ ਤੋਂ ਰਹਿਤ ਹੁੰਦੀ ਆ ਅਤੇ ਆਪਣੇ ਨਾਲ਼ ਨਾਲ਼ ਉਹ ਜਿਹੜੀ ਸਬਜ਼ੀ ਹੈ ਜੇ ਕਦੇ ਥੋੜੀ ਵੱਧ ਮਤਲਬ ਉਹਦੀ ਪੈਦਾਵਾਰ ਹੁੰਦੀ ਹੈ ਤਾਂ ਮੈਂ ਉਹਦਾ ਮੰਡੀਕਰਨ ਕਰਦਾ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹਦੇ ਮੈਂ ਆਪਣੇ ਨਾਲ਼ ਨਾਲ਼ ਅਤੇ ਹੋਰ ਲੋਕਾਂ ਦਾ ਵੀ ਜਿਹੜੀ ਸਿਹਤ ਦਾ ਧਿਆਨ ਰੱਖਦਾ ਅਤੇ ਜਦੋਂ ਮੇਰੀ ਫਸਲ ਹੈ ਉਹ ਕਟਾਈ ਦੇ ਹੋ ਜਾਂਦੀ ਹੈ ਅਤੇ ਮੈਂ ਉਹਦਾ ਮੰਡੀਕਰਨ ਕਰਦਾ ਅਤੇ ਲਾਗੇ ਪਾਸੇ ਦੀਆਂ ਜਿਹੜੀਆਂ ਮੇਰੀਆਂ ਮੰਡੀਆਂ ਨੇ ਅਤੇ ਉਹਨਾਂ ਨਾਲ ਮੇਰਾ ਟਾਈਅਪ ਰਹਿੰਦਾ ਹੈ ਅਤੇ ਉਹਨੂੰ ਫਸਲ ਨੂੰ ਵੇਚ ਕੇ ਆਪਣਾ ਮੈਂ ਵਧੀਆ ਆਪਣਾ ਜਿਹੜਾ ਧਨ ਹੈ ਉਹ ਕਮਾ ਲੈਣਾ ਅਤੇ ਜਿਹਦੇ ਨਾਲ ਮੇਰੀ ਫੈਮਿਲੀ ਬਹੁਤ ਵਧੀਆ ਖੁਸ਼ਹਾਲ ਜ਼ਿੰਦ ਜੀਵਨ ਬਤੀਤ ਕਰ ਰਹੀ ਹੈ